ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਕੀ ਫਤਿਹ ਜੀ

ਹਾਂਜੀ ਦੁੱਧ ਖ਼ਰਾਬ ਨਾ ਜੀ ਸਾ ਸਾਡੇ ਦੁੱਧ ਦੀ ਕੁਆਲਟੀ ਆ ਅੱਜ ਤੱਕ ਕਿਸੇ ਨੇ ਸਾਨੂੰ ਚੈਲੇਂਜ ਨਹੀਂ ਕੀਤਾ ਵੀ ਦੁੱਧ ਸਾਡਾ ਖ਼ਰਾਬ ਹੋ ਗਿਆ ਹੋਵੇ ਦੁੱਧ ਕਵਾਲਟੀ ਵਾਲਾ ਹੁੰਦਾ ਸਾਡਾ ਉਹ ਤੁਹਾਡਾ ਹੀ ਕੋਈ ਉਹ ਹੋਵੇਗਾ ਤੁਹਾਡੇ ਤੋਂ ਸਫ ਤੁਹਾਡਾ ਜਿਹੜਾ ਕੋਈ ਭਾਂਡਾ ਬਰਤਨ ਹੋਵੇਗਾ ਨਾ ਜਿਹਦੇ 'ਚ ਤੁਸੀਂ ਕੀਤਾ ਉਹ ਸਾਫ਼ ਨਹੀਂ ਹੋਣਾ ਇਹ ਤਾਂ ਹੋ ਹੀ ਨਹੀਂ ਸਕਦਾ ਸਾਡੀ ਡਾਇਰੀ ਦਾ ਦੁੱਧ ਤਾਂ ਪੂਰਾ ਮਸ਼ਹੂਰ ਹੈ ਸਾਡੇ ਕੋਲ ਤਾਂ ਬਹੁਤ ਜ਼ਿਆਦਾ ਜਰੀ ਯਾਨੀ ਸਤਿਸੰਗ ਲੋਕ ਨੇ ਜੋ ਸਾਡੀ ਡੈਰੀ ਤੋਂ ਆ ਕੇ ਦੁੱਧ ਲੈ ਕੇ ਜਾਂਦੇ ਆ ਅੱਜ ਤੱਕ ਕਿਸੇ ਨੇ ਸਾਨੂੰ ਕੋਈ ਅ ਉਲਾਂਭਾ ਨਹੀਂ ਦਿੱਤਾ ਨਹੀਂ ਨਹੀਂ ਇਹ ਤਾਂ ਹੋ ਹੀ ਨਹੀਂ ਸਕਦਾ ਨਾ ਨਾ ਅਸੀਂ ਤਾਂ ਕਦੇ ਮਿਲਾਵਟ ਕਰੀ ਨਹੀਂ ਅਤੇ ਤੁਹਾਡੇ 'ਚ ਹੀ ਤੁਹਾਡੇ ਸਫਾਈ ਦੇ ਵਿੱਚ ਹੀ ਕੁਝ ਹੋ ਗਿਆ ਹੋਣਾ ਕੋਈ ਕਿਸੇ ਦਾ ਹੱਥ ਕੋਈ ਖੱਟੇ ਖੁੱਟੇ ਵਾਲਾ ਲੱਗ ਗਿਆ ਹੋਊ ਨਹੀਂ ਅਸੀਂ ਹੋਰ ਡੈਰੀਆਂ ਦਾ ਸਾਨੂੰ ਨਹੀਂ ਪਤਾ ਇੱਥੇ ਸਾਰੇ ਸੰਸਾਰ ਦੇ ਵਿੱਚ ਪਤਾ ਨਹੀਂ ਕਿੰਨੀਆਂ ਕੁ ਡੈਰੀਆਂ ਹੋਣਗੀਆਂ ਪਰ ਸਾਡੀ ਡਾਇਰੀ ਦੀ ਕੁਆਲਿਟੀ ਹੈ ਅਸੀਂ ਵਧੀਆ ਦੁੱਧ ਅ ਇਸਤੇਮਾਲ ਕਰਦੇ ਹਾਂ ਵਧੀਆ ਦੁੱਧ ਹੀ ਅਸੀਂ ਆਪਣੇ ਗਾਹਕਾਂ ਨੂੰ ਦਿੰਦੇ ਹਾਂ ਕਿਉਂਕਿ ਸਾਡੀ ਦੁਕਾਨਦਾਰੀ ਅਸੀਂ ਚਲਾਉਣੀ ਆ ਡਾਇਰੀ 'ਤੇ ਜੇ ਇਸ ਤਰ੍ਹਾਂ ਅਸੀਂ ਦੁੱਧ ਗਲਤ ਦੇਣ ਲੱਗ ਗਏ ਤਾਂ ਸਾਡੀ ਡਾਇਰੀ 'ਤੇ ਕੌਣ ਆਊ ਨਹੀਂ ਠੀਕ ਆ ਤੁਸੀਂ ਦੁੱਧ ਦਿੱਤਾ ਹੋਵੇਗਾ ਇਹ ਬੱਚੇ ਨੂੰ ਜਾਂ ਹੋ ਸਕਦਾ ਪਹਿਲਾਂ ਹੀ ਉਹ ਬਹੁਤ ਢਿੱਲਾ ਹੋਵੇ ਬਿਮਾਰ ਹੋ ਸਕਦਾ ਬੱਚਾ ਪਹਿਲਾਂ ਹੀ ਇ ਦੁੱਧ ਇੰਨਾ ਜਿਹੜਾ ਭਾਰੀ ਚੀਜ਼ ਭਾਰੀ ਵਧੀਆ ਜਿਹੜੀ ਤਾਕਤ ਵਾਲੀ ਚੀਜ਼ ਹੁੰਦੀ ਹੈ ਅਤੇ ਉਹ ਉਹ ਜੇ ਪਹਿਲਾਂ ਬੱਚ ਹੀ ਕੋਈ ਬਿਮਾਰ ਆ ਤਾਂ ਉਹਨੂੰ ਆਪਾਂ ਇੱਕਦਮ ਤਾਕਤ ਵਾਲੀ ਚੀਜ਼ ਦੇ ਦੇਵਾਂਗੇ ਤਾਂ ਉਹ ਤਾਂ ਫਿਰ ਆਪਾਂ ਐਂ ਥੋੜ੍ਹਾ ਕਹਿ ਸਕਦੇ ਹਾਂ ਵੀ ਇਹਦੇ ਨਾਲ ਹੀ ਹੋਇਆ ਦੁੱਧ ਨਾਲ ਹੀ ਬੱਚਾ ਬਿਮਾਰ ਹੋ ਗਿਆ ਨਹੀਂ ਨਹੀਂ ਅਸੀਂ ਤਾਂ ਸਪਰੇ ਤਾਂ ਕਦੇ ਉਹ ਕੀਤਾ ਨਹੀਂ ਅਸੀਂ ਤਾਂ ਕੁਆਲਿਟੀ ਆ ਸਾਡੇ ਕੋਲ ਦੁੱਧ ਦੀ ਤਾਂ ਹੀ ਸਾਡੀ ਇਹ ਡੈਰੀ ਤਾਂ ਇਨ ਇੰਨੇ ਸਨ ਤੋਂ ਪੁਰਾਣੀ ਬਹੁਤ ਪੁਰਾਣੀ ਡਾਇਰੀ ਸਾਡੀ ਚਲਦੀ ਆ ਰਹੀ ਹੈ ਅਤੇ ਇਹ ਇਹਦੀ ਕੁਆਲਟੀ ਹੈ ਕੋਈ ਅਸੀਂ ਐਵੇਂ ਨਹੀਂ ਅਸੀਂ ਕੋਈ ਠੱਗ ਨਹੀਂ ਬੈਠੇ ਵੀ ਐਵੇਂ ਸਪਰੇਟਾ ਕੱਢ ਕੇ ਲੋਕਾਂ ਨੂੰ ਦੇਈ ਜਾਓ ਚਲੋ ਠੀਕ ਆ ਜੀ ਧੰਨ ਧੰਨਵਾਦ